ਨੈਵੀਗੇਸ਼ਨ ਲਈ ਅਸੀਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹਾਂ ਇਹਨਾਂ ਵਿੱਚੋਂ ਦੋ ਤਿੰਨ ਹਨ ਪਹਿਲੀ ਹੈ ਗੂਗਲ ਮੈਪ ਦੂਜੀ ਹੈ ਜੀ ਪੀ ਐਸ ਨੈਵੀਗੇਸ਼ਨ ਤੀਜੀ ਹੈ ਮੈਪਲ ਮੈਪ ਇਹਨਾਂ ਐਪਲੀਕੇਸ਼ਨਾਂ ਦੀ ਸਹਾਇਤਾ ਨਾਲ ਸਾਡਾ ਜੀਵਨ ਬਹੁਤ ਹੀ ਆਸਾਨ ਹੋ ਗਿਆ ਹੈ ਹੁਣ ਅਸੀਂ ਕਿਸੇ ਅਣਜਾਣੀ ਜਗ੍ਹਾ ਮਤਲਬ ਜਿੱਥੇ ਅਸੀਂ ਕਦੇ ਪਹਿਲੀ ਵਾਰ ਵੀ ਜਾਣਾ ਹੋਵੇ ਸਾਨੂੰ ਰਾਹ ਖੇੜਾ ਪੁੱਛਣ ਦੀ ਲੋੜ ਨਹੀਂ ਪੈਂਦੀ ਅਸੀਂ ਨੈਵੀਗੇਸ਼ਨ ਐਪ ਦੇ ਐਪਲੀਕੇਸ਼ਨ ਦੇ ਉੱਤੇ ਆਪਣੇ ਰਿਸ਼ਤੇਦਾਰ ਦਾ ਐਡਰੈਸ ਜਾਂ ਪਤਾ ਭਰ ਕੇ ਸਹੀ ਟਿਕਾਣੇ ਉੱਤੇ ਪਹੁੰਚ ਜਾਂਦੇ ਹਾਂ ਇਹ ਐਪਲੀਕੇਸ਼ਨਾਂ ਸਾਨੂੰ ਸੁਖਾਲੇ ਰਸਤਿਆਂ ਤੋਂ ਲੈ ਕੇ ਜਾਂਦੀਆਂ ਹਨ ਭੀੜ ਭੜੱਕੇ ਵਾਲੀ ਜਗ੍ਹਾ ਤੋਂ ਬਚਾਉਂਦਿਆਂ ਹੋਇਆਂ ਇਹ ਸਾਨੂੰ ਛੋਟੇ ਛੋਟੇ ਰਸਤੇ ਦਿਖਾਉਂਦੀਆਂ ਹਨ ਜਿੱਥੇ ਕਿਤੇ ਅੱਗੇ ਰਸ਼ ਹੋਵੇ ਜਾਂ ਜਾਮ ਭਾਰੀ ਵਾਹਨਾਂ ਦਾ ਜਾਮ ਲੱਗਾ ਹੋਇਆ ਹੋਵੇ ਉਹ ਵੀ ਸਾਨੂੰ ਇਹਨਾਂ ਐਪਲੀਕੇਸ਼ਨਾਂ ਦੇ ਵਿੱਚ ਨਜ਼ਰ ਆ ਜਾਂਦਾ ਹੈ ਇਹਨਾਂ ਐਪਲੀਕੇਸ਼ਨਾਂ ਨੇ ਸਾਰੇ ਪੰਜਾਬ ਕੀ ਸਾਰੇ ਭਾਰਤ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਸੰਸਾਰ ਦੇ ਰਸਤਿਆਂ ਨੂੰ ਆਪਸ ਵਿੱਚ ਜੋੜਿਆ ਹੋਇਆ ਹੈ ਅਸੀਂ ਕਿਸੇ ਵੀ ਜਗ੍ਹਾ 'ਤੇ ਬਹੁਤ ਹੀ ਸੁਲਭ ਤਰੀਕੇ ਦੇ ਨਾਲ ਪਹੁੰਚ ਜਾਂਦੇ ਹਾਂ ਇਹ ਐਪਲੀਕੇਸ਼ਨਾਂ ਸਾਨੂੰ ਸਾਡੇ ਮੋਬਾਈਲ 'ਤੇ ਬਿਲਕੁਲ ਫਰੀ ਉਪਲਬਧ ਹਨ ਮਤਲਬ ਸਾਨੂੰ ਇਹਨਾਂ ਨੂੰ ਇਸਤੇਮਾਲ ਕਰਨ 'ਤੇ ਕੋਈ ਵੱਖਰੇ ਪੈਸੇ ਨਹੀਂ ਭਰਨੇ ਪੈਂਦੇ ਅਸੀਂ ਕੁਝ ਵੀ ਪਾਲ ਸਕਦੇ ਹਾਂ ਇਸ ਤਰ੍ਹਾਂ ਇਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਨਾਲ ਸਾਡਾ ਜੀਵਨ ਬਹੁਤ ਹੀ ਆਸਾਨ ਹੋ ਗਿਆ ਹੈ